ਮੇਰੀਆਂ ਪਸੰਦੀਦਾ ਸ਼ੈਲੀਆਂ ਦੇ ਵਿੱਚ ਧਰਮ ਅਤੇ ਇਤਿਹਾਸ ਬਾਰੇ ਪੜ੍ਹਨਾ ਮੌਜੂਦ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਹੀ ਕਿਤਾਬਾਂ ਪੜ੍ਹਨ ਦੀ ਵਿਸ਼ੇਸ਼ ਰੁਚੀ ਰੱਖਦਾ ਹਾਂ ਅਤੇ ਅੱਗੇ ਤੋਂ ਵੀ ਰੱਖਾਂਗਾ ਮੈਂ ਪਿਛਲੇ ਦਿਨੀਂ ਇੱਕ ਕਿਤਾਬ ਜੋ ਪੰਜਾਬ ਦੇ ਸ਼ਹੀਦਾਂ ਦੇ ਨਾਲ ਸਬੰਧਿਤ ਸੀ ਅਤੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਆ ਉਹ ਪੜ੍ਹੀ ਜਿਹਦੇ ਵਿੱਚ ਉਹਨਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਕੀ ਕੀ ਕੁਰਬਾਨੀਆਂ ਕੀਤੀਆਂ ਉਹ ਪੜ੍ਹਿਆ ਔਰ ਉਹਨਾਂ ਨੇ ਆਪਣੇ ਧਰਮ ਦੇਸ਼ ਦੀ ਰਾਖੀ ਦੇ ਲਈ ਕਿਵੇਂ ਆਪਣੀਆਂ ਜਾਨਾਂ ਵਾਰੀਆਂ ਉਹ ਉਹਦੇ ਵਿੱਚ ਬੇਮਿਸਾਲ ਗੱਲਾਂ ਸਨ ਅਤੇ ਜਿਹਨਾਂ ਨੂੰ ਪੜ੍ਹ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਅਤੇ ਇਹ ਮੈਂ ਕਿਤਾਬਾਂ ਅੱਗੇ ਆਪਣੇ ਵਿਦਿਆਰਥੀ ਨੂੰ ਦੱਸਾਂਗਾ ਜਿਹਨਾਂ ਦੇ ਨਾਲ ਉਹ ਇਹਨਾਂ ਤੋਂ ਭਵਿੱਖ ਵਿੱਚ ਸੇਧ ਲੈ ਸਕਦੇ ਹਨ ਅਤੇ ਆਪਣੇ ਦੇਸ਼ ਅਤੇ ਕੌਮ ਦੇ ਲਈ ਹੋਈਆਂ ਸ਼ਹੀਦੀਆਂ ਨੂੰ ਉਹ ਜਿੰਦਾ ਰੱਖ ਸਕਦੇ ਹਨ ਕਿਵੇਂ ਵੱਖ ਵੱਖ ਸ਼ਹੀਦਾਂ ਨੇ ਜਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿਹਨਾਂ ਕਿਹਨਾਂ ਲੋਕਾਂ ਦਾ ਯੋਗਦਾਨ ਰਿਹਾ ਉਹਨਾਂ ਦੇ ਬਾਰੇ ਵੀ ਵਿਦਿਆਰਥੀ ਨੂੰ ਪਤਾ ਲੱਗੇਗਾ